ਪੰਜਾਬ ਵਿੱਚ ਰਾਜਨੀਤਿਕ ਪ੍ਰਣਾਲੀ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਨਾਗਰ ਨਾਗਰਿਕਾਂ ਦੀ ਨੁਮਾਇੰਦਗੀ ਅਤੇ ਭਾਗੀਦਾਰੀ ਬਹੁਤ ਯਕੀਨ ਹੈ ਕਿਉਂਕਿ ਇਹਨਾਂ ਤੋਂ ਬਗੈਰ ਬਿਲਕੁਲ ਵੀ ਰਾਜਨੀਤਿਕ ਪ੍ਰਣਾਲੀ ਅੱਗੇ ਨਹੀਂ ਵੱਧ ਸਕਦੀ ਕਿਉਂਕਿ ਦੇਖੋ ਤੁਸੀਂ ਜਿੰਨੀ ਕਿਉਂਕਿ ਚੋਣਾਂ ਇੱਕ ਚੋਣਾ ਦੇ ਚੋਣਾਂ ਜਦੋਂ ਹੁੰਦੀਆਂ ਹਨ ਤੇ ਜਨਤਕ ਸਲਾਹ ਤੇ ਮਸ਼ਵਰੇ ਤੇ ਉਸ ਤੋਂ ਬਿਨਾਂ ਨਹੀਂ ਚੱਲ ਸਕਦਾ ਕਿਉਂਕਿ ਦੇਖੋ ਜਦੋਂ ਕਿਸੇ ਨੇ ਵੀ ਵੋਟਾਂ ਚ ਖੜੇ ਹੋਣਾ ਹੈ ਤੇ ਉਹਨਾਂ ਨੇ ਘਰ ਘਰ ਘੁੰਮਣਾ ਹੈ ਆ ਕੇ ਗਲੀਆਂ ਵਿੱਚ ਘੁੰਮਣਾ ਸਭ ਤੋਂ ਵੋਟਾਂ ਮੰਗਣ ਦੀ ਅਪੀਲ ਕਰਨੀ ਹੈ ਸਾਰੇ ਰਲ ਕੇ ਉਹਨਾਂ ਦੇ ਨਾਲ ਸਾਂਝੇਦਾਰੀ ਨਿਭਾਉਂਦੇ ਹਨ ਤਾਂ ਹੀ ਉਹ ਇੱਕ ਚੰਗਾ ਬੰਦਾ ਆਪਣੇ ਦੇਸ਼ ਨੂੰ ਆਪਣੇ ਸਮਾਜ ਨੂੰ ਆਪਣੇ ਸ਼ਹਿਰ ਨੂੰ ਦੇ ਸਕਦੇ ਹਾਂ ਤਾਂ ਕਿ ਜੋ ਅੱਗੇ ਚੱਲ ਕੇ ਉਹਨਾਂ ਦੇ ਕੋਈ ਵੀ ਤਰ੍ਹਾਂ ਦੇ ਕੰਮ ਆ ਸਕੇ ਅਤੇ ਕੰਮ ਕਰਵਾ ਸਕੇ ਤੇ ਉਹ ਕੰਮ ਕਰਵਾਉਣ ਦੇ ਵਿੱਚ ਉਹਨਾਂ ਦੀ ਇੱਕ ਬਹੁਤ ਜਿਆਦਾ ਭਾਗੀਦਾਰੀ ਹੁੰਦੀ ਹੈ ਤੇ ਬਾਕੀ ਲੋਕੀ ਆਪਣਾ ਟਾਈਮ ਡਿਵੋਸ਼ਨ ਟਾਈਮ ਦਿੰਦੇ ਹਨ ਆਪਣਾ ਸਮਾਂ ਦਿੰਦੇ ਹਨ ਆਪਣਾ ਜਾਣਦੇ ਹਨ ਉਹਨਾਂ ਦੇ ਨਾਲ ਉਹ ਵੀ ਇੱਕ ਜਿਹੜੀ ਹੈ ਕਿ ਉਹ ਵੀ ਬਹੁਤ ਚੰਗਾ ਰੋਲ ਨਿਭਾਉਂਦੀ ਹੈ ਉਹ ਖੜੇ ਹੁੰਦੇ ਹਨ ਕੋਈ ਨਾ ਕੋਈ ਬੰਦਾ ਫਿਰ ਉਹ ਇੱਕ ਸਾਰੇ ਚੋਣਾਂ ਹੁੰਦੀਆਂ ਹਨ ਸਾਰੇ ਲੋਕੀ ਸਾਥ ਦਿੰਦੇ ਹਨ ਤੇ ਜਦੋਂ ਚੋਣਾਂ ਵਾਲੇ ਆਂਦੇ ਹਨ ਕਿਤੇ ਨਾ ਕਿਤੇ ਜਦੋਂ ਵੀ ਇਹਨਾਂ ਦਾ ਕੋਈ ਸੈਂਟਰ ਬਣਦਾ ਹੈ ਉਥੇ ਸਾਰੇ ਟੀਚਰ ਵਗੈਰਾ ਡਿਊਟੀ ਲਾਈ ਜਾਂਦੀ ਹੈ ਜਿਹੜੇ ਵੀ ਸਾਡੇ ਸਮਾਜ ਦੇ ਟੀਚਰ ਵਗੈਰਾ ਜੋ ਵੀ ਹੁੰਦੇ ਹਨ ਉਹ ਆਪਣੀਆਂ ਡਿਊਟੀਆਂ ਬਖੂਬੀ ਤੌਰ ਤੇ ਨਿਭਾਉਂਦੇ ਹਨ ਉਹਨਾਂ ਨੂੰ ਭਾਵੇਂ ਪੈਸੇ ਮਿਲਦੇ ਹਨ ਭਾਵੇਂ ਦਿਨਾਂ ਦੀ ਤਨਖਾਹ ਮਿਲਦੀ ਹੈ ਉਸ ਪੈਸ ਦਿਹਾੜੀ ਤੇ ਪਰ ਚਲੋ ਉਹ ਆਪਣਾ ਟਾਈਮ ਕੱਢ ਕੇ ਆਪਣੀ ਛੁੱਟੀ ਉਥੇ ਆਉਂਦੇ ਹਨ ਲੋਕਾਂ ਦੀ ਸਹਾਇਤਾ ਕਰਦੇ ਹਨ ਲੋਕਾਂ ਨੂੰ ਉਹਦੇ ਵਿੱਚ ਪਾਣ ਵਿੱਚ ਮਦਦ ਕਰਦੇ ਹਨ ਧੰਨਵਾਦ